ਭਾਰਤ ਕਈ ਸੱਭਿਆਚਾਰਾਂ ਦਾ ਦੇਸ਼ ਹੈ ਜਿੱਦਾਂ ਹਿੰਦੂ ਮੁਸਲਿਮ ਸਿੱਖ ਈਸਾਈ ਅਤੇ ਆਦਿ ਅੱਜ ਮੈਂ ਤੁਹਾਨੂੰ ਪੰਜਾਬੀ ਸੱਭਿਆਚਾਰ ਦੇ ਬਾਰੇ ਦੱਸਣੇ ਜਾ ਰਿਹਾ ਹਾਂ ਪੰਜਾਬੀ ਭਾਰਤੀ ਉਪ ਮਹਾਂਦੀਪ ਦੇ ਉੱਤਰ ਪੱਛਮੀ ਹਿੱਸੇ ਵਿੱਚ ਸਥਿੱਤ ਇਤਿਹਾਸ ਅਤੇ ਜੀਵਨ ਤ ਸੱਭਿਆਚਾਰ ਨਾਲ ਭਰਪੂਰ ਇੱਕ ਖੇਤਰ ਹੈ ਇੱਕ ਲੰਬੇ ਅਤੇ ਮੰਜੀਲ ਅਤੀਤ ਦੇ ਨਾਲ ਪੰਜਾਬ ਦਾ ਸੱਭਿਆਚਾਰ ਇੱਕ ਰੰਗੀਨ ਹੈ ਜੋ ਪੁਰਾਤਨ ਸੱਭਿਆਚਾਰਾਂ ਹਮਲਿਆ ਅਤੇ ਇਸ ਦੇ ਲੋਕਾਂ ਦੇ ਲਚਕੀਲੇਪਨ ਅਤੇ ਪ੍ਰਭਾਵਾਂ ਨਾਲ ਬੁਣਿਆ ਗਿਆ ਹੈ ਪੰਜਾਬ ਦਾ ਨਾਂ ਫਾਰਸੀ ਸ਼ਬਦਾਂ ਪੰਜ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਪੰਜ ਅਤੇ ਆਬ ਦਾ ਅਰਥ ਹੈ ਪਾਣੀ ਜੋ ਕਿ ਇਸ ਖੇਤਰ ਵਿੱਚੋਂ ਵਗਦੇ ਹਨ ਪੰਜ ਦਰਿਆਵਾਂ ਬਿਆਸ ਚਿਨਾਬ ਜੇਹਲਮ ਰਾਵੀ ਅਤੇ ਸਤਲੁਜ ਦਾ ਹਵਾਲਾ ਦਿੰਦੇ ਹਨ ਭਾਰਤ ਕਈ ਤਰੀਕਿਆਂ ਨਾਲ ਹੋਰ ਸੱਭਿਆਚਾਰਾਂ ਤੋਂ ਵੱਖ ਹੈ ਇਸ ਕਰਕੇ ਹੈ ਕਿਉਂਕਿ ਇਸ ਵਿੱਚ ਧਰਮਾਂ ਦਾ ਆਦਰ ਕੀਤਾ ਜਾਂਦਾ ਹੈ ਤਾਂ ਧਰਮਾਂ ਨੂੰ ਇੱਕ ਜਿੱਦਾਂ ਦਾ ਸਮਾਨ ਮਿਲਦਾ ਹੈ